ਹਾਂਜੀ ਕਰੋਨਾ ਦੇ ਸਮੇਂ 'ਚ ਵੀਡੀਓ ਕੋਂਨਫਰੈਂਸਿੰਗ ਦੇ ਸਾਨੂੰ ਬਹੁਤ ਫ਼ਾਇਦੇ ਮਿਲੇ ਜਦੋਂ ਆਪਾਂ ਘਰ ਤੋਂ ਬਾਹਰ ਨਹੀਂ ਜਾ ਸਕਦੇ ਸੀ ਲੋਕਾਂ ਨੂੰ ਨਹੀਂ ਮਿਲ ਸਕਦੇ ਸੀ ਤਾਂ ਵੀਡੀਓ ਕੋਂਨਫਰੈਂਸਿੰਗ ਨੇ ਘਰ ਬੈਠੇ ਸਾਡਾ ਕੰਮ ਆਸਾਨ ਕਰ ਦਿੱਤਾ ਇਸ ਨਾਲ ਸਿਰਫ਼ ਸਫ਼ਰ ਦੀ ਲੋੜ ਵੀ ਖਤਮ ਹੋ ਗਈ ਸਗੋਂ ਇਹ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਵਿੱਚ ਵੀ ਮਦਦਗਾਰ ਸਾਬਿਤ ਹੋਇਆ ਦੂਸ ਦੂਜਾ ਇਹ ਸਮੇਂ ਵਿੱਚ ਵਿਧਾਇਕ ਅਤੇ ਪ੍ਰੋਫੈਸ਼ਨ ਮੁਲਾਕਾਤ ਤਾਂ ਵੀ ਵੀਡੀਓ ਕੋਂਨਫਰੈਂਸਿੰਗ ਨਾਲ ਕਾਫ਼ੀ ਲਾਭਦਾਇਕ ਹੋਈਆ ਆਸਾਨੀ ਨਾਲ ਲੋਕ ਆਪਣੇ ਕੰਮ ਜਾਰੀ ਰੱਖ ਸਕੇ ਵਿਧਾਇਕ ਸੰਸਥਾਵਾਂ ਨੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਇਸ ਨਾਲ ਸਮਾਂ ਅਤੇ ਪੈਸਾ ਬਚਾਅ ਅਤੇ ਲੋਕਾਂ ਦੇ ਘਰ ਹੀ ਆਪਣੀ ਦਿਨ ਚਰਿਆਂ ਨੂੰ ਸਹੀ ਢੰਗ ਨਾਲ ਅੱਗੇ ਵਧਾਇਆ ਵੀਡੀਓ ਕੋਂਨਫਰੈਂਸਿੰਗ ਦੇ ਵੈਸੇ ਤਾਂ ਬਹੁਤ ਫ਼ਾਇਦੇ ਸੀ ਇੱਕ ਤਾਂ ਇਹ ਸਮਾਂ ਬਚਾਉਂਦਾ ਆ ਦੂਜਾ ਘਰਾਂ ਜਾ ਦਫ਼ਤਰਾਂ ਤੋਂ ਵੀ ਮੀਟਿੰਗ ਵਿੱਚ ਹਿੱਸਾ ਲੈ ਸਕਦੇ ਹਾਂ ਜਿਸ ਨਾਲ ਸਫ਼ਰ ਦੀ ਲੋੜ ਨਹੀਂ ਹੁੰਦੀ ਦੂਜਾ ਆਸਾਨੀ ਦੇ ਨਾਲ ਸਹਿਯੋਗ ਅਤੇ ਵਿਚਾਰ ਸਾਂਝੀ ਕਰਨ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਨਾਲ ਜਿੱਥੇ ਕਈ ਲੋਕ ਇਸ ਸਮੇਂ ਵਿੱਚ ਆਨਲਾਈਨ ਮਿਲ ਕੇ ਵਿਚਾਰ ਚਰਚਾ ਕਰ ਸਕਦੇ ਹਨ ਵੀਡੀਓ ਕੋਂਨਫਰੈਂਸਿੰਗ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਮੀਟਿੰਗ ਆਪਾਂ ਅਟੈਂਡ ਕਰ ਸਕਦੇ ਹਾਂ ਇਸ ਲਈ ਸਾਨੂੰ ਲੰਬੇ ਸਫ਼ਰ ਕਰਨ ਦੀ ਲੋੜ ਵੀ ਨਹੀਂ ਹੈ ਇਹ ਇੱਕ ਹਿੱਸੇਦਾਰ ਦੀ ਸੁਵਿਧਾ ਦਿੰਦਾ ਹੈ ਜਿੱਥੇ ਕਈ ਲੋਕ ਇੱਕ ਹੀ ਸਮੇਂ ਵਿੱਚ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ ਇਸ ਦਾ ਹੋਰ ਫ਼ਾਇਦਾ ਹੈ ਕਿ ਮੀਟਿੰਗ ਨੂੰ ਰਿਕਾਰਡ ਕਰਨ 'ਤੇ ਰਿਕਾਰਡ ਕਰਨ ਤੋਂ ਬਾਅਦ ਰਿਵਿਊ ਕੀਤਾ ਜਾਂਦਾ ਹੈ ਪਰ ਵੀਡੀਓ ਕੋਂਨਫਰੈਂਸਿੰਗ ਦੀ ਕੁਝ ਨੁਕਸਾਨ ਇੱਦਾਂ ਹੁੰਦੇ ਹੈਗੇ ਜਿਵੇਂ ਇੰਟਰਨੈਟ ਕਨੈਕਸ਼ਨ ਦੀ ਸਮੱਸਿਆ ਆ ਜਾਂਦੀ ਆ ਜਾਂ ਕੋਈ ਸਾਹਮਣਾ ਕਰਨਾ ਪੈਂਦਾ ਜਿਸ ਵਿੱਚ ਮੀਟਿੰਗ 'ਚ ਵਿਘਨ ਵੀ ਪੈ ਜਾਂਦਾ ਆ ਅਤੇ ਕਈ ਵਾਰ ਆਪਾਂ ਪਰਸਨਲ ਕਲੈਕਸ਼ਨ ਦੀ ਕਮੀ ਵੀ ਮਹਿਸੂਸ ਕਰਦੇ ਹਾਂ ਅਤੇ ਫੇਸ ਟੂ ਫੇਸ ਇੰਟਰੈਕਸ਼ਨ ਵੀ ਕੁਦਰਤੀ ਹੁੰਦਾ ਹੈ ਉਹਦੇ ਨਾਲ ਸਾਡੀਆਂ ਪਾਵਨ ਪਾਵਨਾਤਮਾਕਾ ਵਿਚਾਰ ਵਿਮਰਸ਼ ਅਤੇ ਟੀਮ ਬੋਰਡਿੰਗ ਦੇ ਸਮੇਂ ਹੁੰਦੇ ਆ ਪਰ ਵੀਡੀਓ ਕੋਂਨਫਰੈਂਸਿੰਗ ਸੁਰੱਖਿਆ ਅਤੇ ਚਿੰਤਾ ਵੀ ਕਰ ਸਕਦੀ ਹੈ ਜਿਵੇਂ ਸ੍ਵ ਸੰਵੇਦਨਸ਼ੀਲ ਜਾਣਕਾਰੀਆਂ ਲੀਕ ਹੋ ਜਾਂਦੀਆਂ ਨੇ ਆਖਿਰਕਾਰ ਸਭ ਨੂੰ ਵਧੀਆ ਇੰਟਰਨੈਟ ਕਨੈਕਸ਼ਨ ਦੀਆਂ ਕਮਪੈਟੀਵਲ ਡਿਵਾਇਸ ਨਹੀਂ ਮਿਲਦੀ ਜਿਸ ਨਾਲ ਵੀਡੀਓ ਕੋਂਨਫਰੈਂਸਿੰਗ ਨੂੰ ਅਸੈਸ ਵੀ ਨਹੀਂ ਮਿਲਦਾ ਅਤੇ ਇਹਦੇ ਨਾਲ ਸਾਨੂੰ ਡਿਸਟਰੈਕਸ਼ਨ ਵੀ ਹੁੰਦੀ ਹੈ ਕਈ ਵਾਰ ਇਹਨਾਂ ਸਾਰਿਆਂ ਪੁਆਇੰਟਸ ਨੂੰ ਸਹੀ ਤਰੀਕੇ ਨਾਲ ਉਪਯੋਗ ਕਰਨਾ ਚਾਹੀਦਾ ਤਾਂ ਕਿ ਉਸ ਦੇ ਫ਼ਾਇਦੇ ਮਿਲਣ ਅਤੇ ਨੁਕਸਾਨ ਨਾ ਹੋਵੇ